ਮੈਂ ਅਜਿਹੇ ਵਿਅਕਤੀ ਲਈ ਸਲਾਹ ਚਿੱਤਰਕਾਰੀ ਦੇ ਵਿਸ਼ੇ 'ਤੇ ਸਲਾਹ ਦਵਾਂਗਾ ਅੱਜ ਦੀ ਡੇਟ ਵਿੱਚ ਚਿੱਤਰਕਾਰੀ ਸ਼ੁਰੂ ਕਰਨ ਵਾਲਾ ਬੰਦਾ ਬਹੁਤ ਉੱਪਰ ਤੱਕ ਪਹੁੰਚ ਸਕਦਾ ਹੈ ਇਹ ਚਿੱਤਰਕਾਰੀ ਇੱਕ ਇੰਨੀ ਪ੍ਰਫੁਲਿਤ ਹੋ ਗਈ ਹੈ ਜਿਵੇਂ ਕਿ ਕੰਪਨੀਸ ਇੰਨੀਆਂ ਆ ਗਈਆਂ ਹੈ ਕੋਈ ਐਡਵੋਟਾਈਜ਼ਮੈਂਟ ਕਿਸੇ ਨੇ ਦੇਣੀ ਹੈ ਉਹ ਵੀ ਚਿੱਤਰਕਾਰੀ ਤੋਂ ਹੀ ਸ਼ੁਰੂ ਹੁੰਦੀ ਹੈ ਜਿਵੇਂ ਅੱਜ ਕੱਲ੍ਹ ਸੀਮਤ ਆਪਣਾ ਜੇ ਛੋਟੇ ਲੈਵਲ 'ਤੇ ਸੋਚੋ ਅੰਬੂਜਾ ਸੀਮਿੰਟ ਏ ਸੀ ਸੀ ਸੀਮਿੰਟ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਐਡਵਟਾਈਮੈਂਟ ਦੇਣੀ ਹੁੰਦੀ ਹੈ ਤਾਂ ਉਹ ਪਿੰਡਾਂ ਵਿੱਚ ਚਿੱਤਰਕਾਰੀ ਵਾਲੇ ਬੰਦੇ ਨੂੰ ਹੀ ਲੱਭਦੇ ਹਨ ਜਿਵੇਂ ਆਪਣੇ ਪਿੰਡਾਂ ਦੀਆਂ ਮੋਟਰਾਂ ਹੋ ਗਈਆਂ ਪਿੰਡਾਂ ਦੀ ਕੋਈ ਕੰਧ ਹੋ ਗਈ ਜਾਂ ਕੋਈ ਵੀ ਪਿੰਡਾਂ ਵਿੱਚ ਦੁਕਾਨਾਂ ਹੋ ਗਈਆਂ ਤਾਂ ਉੱਥੇ ਉਹ ਉਹਨਾਂ ਨੂੰ ਜੌਬ ਦੇ ਦਿੰਦੇ ਹਨ ਅਤੇ ਉਹ ਉਹਨਾਂ ਦੀ ਚਿੱਤਰਕਾਰੀ ਨਾਲ ਹੀ ਕੰਪਨੀਆਂ ਦੀ ਐਡਵਟਾਈਜ਼ਮੈਂਟ ਹੋ ਜਾਂਦੀ ਹੈ ਅਤੇ ਬੰਦੇ ਬੰਦੇ ਨੂੰ ਜੌਬ ਮਿਲ ਜਾਂਦੀ ਹੈ ਪਰ ਅੱਜ ਦੀ ਡੇਟ ਵਿੱਚ ਜੇ ਸੋਚਿਆ ਜਾਵੇ ਵੀ ਪਹਿਲਾਂ ਆਪਾਂ ਸੋਚਦੇ ਸੀ ਵੀ ਚਿੱਤਰਕਾਰੀ ਪਤਾ ਨਹੀਂ ਕੀ ਹੈ ਕੀ ਨਹੀਂ ਪਰ ਅੱਜ ਇਹ ਜੋ ਜੋ ਚਿੱਤਰਕਾਰੀ ਦਾ ਵਿਸ਼ਾ ਤਾਂ ਤੁਹਾਡੀ ਤੁਹਾਡਾ ਹੁਨਰ ਤੁਹਾਡੀ ਜੌਬ ਵਿੱਚ ਕਨਵਰਟ ਹੋ ਗਿਆ ਹੈ ਪਹਿਲਾਂ ਦਾ ਇੱਦਾਂ ਹੁੰਦਾ ਸੀ ਨਾ ਵੀ ਚਲੋ ਚਿੱਤਰਕਾਰੀ ਹੈ ਕੋਈ ਪੁੱਛਦਾ ਨਹੀਂ ਸੀ ਪਰ ਅੱਜ ਜਿੱਦਾਂ ਵੀ ਜ਼ਮਾਨਾ ਡਿਵਲਪ ਹੋਇਆ ਹੈ ਇਹਦੇ ਵਿੱਚ ਤੁਸੀਂ ਲਗਾ ਲਓ ਜਿਵੇਂ ਕਿ ਕੰਪਨੀਜ਼ ਲਗਾ ਲਓ ਜਾਂ ਕੋਈ ਆ ਕੰਪੀਟੀਸ਼ਨ ਕਿੰਨੇ ਹੁੰਦੇ ਆ ਚਿੱਤਰਕਾਰੀ ਦੇ ਉਹਦੇ ਵਿੱਚ ਤੁਸੀਂ ਆਪਣਾ ਚਿੱਤਰਕਾਰੀ ਨੂੰ ਅਜ਼ਮਾ ਸਕਦੇ ਆ ਜੇ ਤੁਸੀਂ ਹੁਣ ਅੱਗੇ ਤੁਹਾਡੇ ਕੋਲ ਕੋਈ ਇੰਨੀ ਮੈਂ ਤੁਹਾਨੂੰ ਕਿੱਦਾਂ ਦੱਸਾਂ ਇੰਨਾ ਨਹੀਂ ਹੁੰਦਾ ਸੀ ਜੋ ਤੁਸੀਂ ਕਿਤਾਬਾਂ ਵਿੱਚ ਪੜ੍ਹਿਆ ਉਹੀ ਹੁੰਦਾ ਸੀ ਪਰ ਅੱਜ ਦੀ ਡੇਟ ਵਿੱਚ ਤਾਂ ਤੁਹਾਡੇ ਕੋਲ ਯੂਟਿਊਬ ਲਗਾ ਲਓ ਆਪਣਾ ਜਿਹੜਾ ਹੁਨਰ ਨੂੰ ਸੁਧਾਰਨਾ ਏ ਤੁਸੀਂ ਕੋਈ ਲੈਵਲ 'ਤੇ ਲੈ ਕੇ ਜਾਣਾ ਹੈ ਜਿਹੜੀ ਚੀਜ਼ ਨਹੀਂ ਪਤਾ ਲੱਗੀ ਝੱਟ ਤੁਹਾਡੇ ਫੋਨ 'ਤੇ ਹੁੰਦੀ ਹੈ ਤੁਸੀਂ ਆਪਣਾ ਅਰਾਮ ਨਾਲ ਇਸ ਨੂੰ ਬਹੁਤ ਉੱਪਰ ਤੱਕ ਲੈ ਕੇ ਜਾ ਸਕਦੇ ਅਤੇ ਆਪਣਾ ਜੀਵਨ ਵਧੀਆ ਬਤੀਤ ਕਰ ਸਕਦੇ ਹੋ ਮੈਂ ਤਾਂ ਇਹੀ ਸਲਾਹ ਦੇਵਾਂਗਾ